ਜਦੋਂ ਕਿਸੇ ਬਜ਼ੁਰਗ ਦੀ ਮੌਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਘਰ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਜੇ ਤਾਂਗਰਮੀ ਹੋਏ ਤਾਂ ਫ੍ਰਿਜਰ ਵਿੱਚ ਲਗਾਇਆ ਜਾਂਦਾ ਜੇ ਕਿਸੇ ਨੇ ਸਵੇਰੇ ਸੰਸਕਾਰ ਕਰਨਾ ਹੋਏ ਜੇ ਸਿਆਲ਼ ਹੋਏ ਤਾਂ ਇਸ ਤਰ੍ਹਾਂ ਵੀ ਰੱਖ ਸਕਦੇ ਹਾਂ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਫੋਨ ਕਰਕੇ ਦੱਸਿਆ ਜਾਂਦਾ ਫ਼ਿਰ ਜਦੋਂ ਸਾਰੇ ਆ ਜਾਂਦੇ ਆ ਸਵੇਰੇ ਉਹਨਾਂ ਦੀ ਵੇਟ ਹੁੰਦੀ ਹੈ ਜਦੋਂ ਸਾਰੇ ਆ ਜਾਂਦੇ ਫ਼ਿਰ ਉਹਨਾਂ ਨੂੰ ਅੰਤਿਮ ਸਸ ਅੰਤਿਮ ਇਸ਼ਨਾਨ ਕਰਵਾਇਆ ਜਾਂਦਾ ਹੈ ਇਸ਼ਨਾਨ ਕਰਨ ਤੋਂ ਬਾਅਦ ਜੋ ਨਵੇਂ ਕੱਪੜੇ ਬਣਵਾਏ ਹੁੰਦੇ ਆ ਉਹ ਪਵਾਏ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੀ ਜਿਸ ਤੱਕ ਪੌੜੀ ਪੌੜੀ ਬਣਾਈ ਹੁੰਦੀ ਉਹ 'ਤੇ ਲਿਟਾ ਕੇ ਫ਼ਿਰ ਉੱਪਰ ਜਿੰਨੇ ਵੀ ਰਿਸ਼ਤੇਦਾਰ ਕੋਈ ਵੀ ਕੁਝ ਲੈ ਕੇ ਆਇਆ ਹੁੰਦਾ ਲੋਈ ਕੰਬਲ ਉਹਨਾਂ 'ਤੇ ਪਾਏ ਜਾਂਦੇ ਆ ਉਸ ਤੋਂ ਬਾਅਦ ਜੋ ਵੀ ਜਿਸ ਤਰ੍ਹਾਂ ਬਹੂਆਂ ਹੁੰਦੀਆਂ ਨੇ ਉਹ ਮੱਥਾ ਟੇਕਦੀਆਂ ਨੇ ਉਸ ਤੋਂ ਬਾਅਦ ਚਾਰ ਬੰਦੇ ਅਰਦਾਸ ਕਰਕੇ ਚਾਰ ਬੰਦੇ ਕੰਧਿਆਂ 'ਤੇ ਉਠਾ ਕੇ ਬਜ਼ੁਰਗ ਨੂੰ ਸਿਵਿਆਂ ਵੱਲ ਲੈਕੇ ਜਾਂਦੇ ਹੈ ਜਦੋਂ ਆਪਾਂ ਅੱਧ ਵਿੱਚ ਜਾਂਦੇ ਹਾਂ ਤਾਂ ਜਿਹੜੇ ਚਾਰ ਬੰਦੇ ਹੁੰਦੇ ਆ ਉਹ ਦੋ ਦੋ ਦੋ ਅੱਗੇ ਦੋ ਪਿੱਛੇ ਉਹਨਾਂ ਦੇ ਪਾਸੇ ਚੇਂਜ ਕਰਕੇ ਦੋ ਅੱਗੇ ਦੋ ਪਿੱਛੇ ਚੇਂਜ ਕਰਕੇ ਉਹਨਾਂ ਨੂੰ ਫਿਰ ਸਿਵਿਆਂ ਵਿੱਚ ਜਾਂਦੇ ਨੇ ਉਸ ਤੋਂ ਬਾਅਦ ਜੋ ਉਹਨਾਂ ਦਾ ਬੇਟਾ ਹੁੰਦਾ ਏ ਬੇਟਾ ਓਸ ਅੰਤਿਮ ਸੰਸਕਾਰ ਕਰਦਾ ਅਰਦਾਸ ਕਰਦਾ ਅੰਤਿਮ ਅ ਅਰਦਾਸ ਹੁੰਦੀ ਹੈ ਅੰਤਿਮ ਸੰਸਕਾਰ ਹੁੰਦਾ ਏ ਉਸ ਤੋਂ ਬਾਅਦ ਜਦੋਂ ਆਪਾਂ ਸੰਸਕਾਰ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਆ ਜਾਂਦੇ ਹਾਂ ਗੁਰਦੁਆਰਾ ਸਾਹਿਬ ਆ ਕੇ ਪਹਿਲਾਂ ਮੱਥ ਮੂੰਹ ਹੱਥ ਧੋਕੇ ਇਸ ਮੂੰਹ ਹੱਥ ਧੋਤਾ ਜਾਂਦਾ ਏ ਪੰਜ ਇਸ਼ਨਾਨਾਂ ਕਰਕੇ ਫ਼ਿਰ ਉਸ ਤੋਂ ਬਾਅਦ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਜਾਂਦੇ ਹਾਂ ਮੱਥਾ ਟੇਕਦੇ ਹਾਂ ਫ਼ਿਰ ਭਾ ਰਾਗੀ ਸਿੰਘ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹੁੰਦੇ ਨੇ ਉਹ ਪਾਠ ਕਰ ਅਰਦਾਸ ਕਰਦੇ ਆ ਹੁਕਮਨਾਮਾ ਲੈਂਦੇ ਨੇ ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਦੇਗ ਵਰਤਾਉਣ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਭੋਗ ਚੌਥਾ ਕਿੰਨੀ ਤਰੀਕ ਨੂੰ ਹੈ ਕਿਹੜੇ ਵਾਰ ਬਣਦਾ ਭੋਗ ਕਿਹੜੇ ਵਾਰ ਬਣਦਾ ਉਸ ਤੋਂ ਬਾਅਦ ਫ਼ਿਰ ਲੰਗਰ ਛਕਾਇਆ ਜਾਂਦਾ ਲੰਗਰ ਛਕਾਉਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਚਲ ਜਾਂਦੇ ਆ ਉਸ ਤੋਂ ਬਾਅਦ ਚੌਥਾ ਹੁੰਦਾ ਏ ਚੌਥੇ ਵਾਲੇ ਦਿਨ ਚੁ ਫੁੱਲ ਚੁਗੇ ਜਾਂਦੇ ਆ ਫੁੱਲ ਚੁੱਗ ਕੇ ਚੌਥੇ ਵਾਲੇ ਦਿਨ ਹੀ ਕੀਰਤਪੁਰ ਸਾਹਿਬ ਪਤਾਲਪੁਰੀ ਪਤਾਲਪੁਰੀ ਫੁੱਲ ਤਾਰੇ ਜਾਂਦੇ ਨੇ ਉਸ ਤੋਂ ਬਾਅਦ ਜਿੰਨੇ ਵੀ ਨਾਲ਼ ਗਏ ਹੁੰਦੇ ਆ ਕਿਸੇ ਨੂੰ ਕੋਈ ਬਰਤਨ ਲੈ ਕੇ ਦਿੰਦਾ ਕੋਈ ਕੁਝ ਅਰਦਾਸ ਕੀਤੀ ਜਾਂਦੀ ਉਹਨਾਂ ਦੇ ਨਾਮ ਦੇ ਕੱਪੜੇ ਬਰਤਨ ਦਾਨ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਸਾਰੇ ਘਰ ਆ ਜਾਂਦੇ ਫਿਰ ਪਾਠ ਰਖਾਇਆ ਜਾਂਦਾ ਸੱਤਵੇਂ ਦਿਨ ਫਿਰ ਪਾਠ ਤੋਂ ਬਾਅਦ ਭੋਗ ਪਾਇਆ ਜਾਂਦਾ ਏ ਭੋਗ ਵਾਲੇ ਦਿਨ ਸਾਰੇ ਮਹਿਮਾਨ ਆਏ ਹੁੰਦੇ ਆ ਰੋਟੀ ਪਾਣੀ ਵਧੀਆ ਕਰਕੇ ਇਸ ਤਰ੍ਹਾਂ ਹੀ ਸਾਡੇ ਅੰਤਿਮ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ